ਮੇਰਾ ਸਭ ਤੋਂ ਮਨਪਸੰਦ ਫੋਟੋਗ੍ਰਾਫਰ ਸਾਡੀ ਗਲੀ ਮੁਹੱਲੇ ਦੇ ਵਿੱਚ ਹੀ ਹੈ ਉਹ ਉਸਦਾ ਨਾਮ ਕਾਲਾ ਫੋਟੋਗ੍ਰਾਫਰ ਹੈ ਉਹ ਬੜੀ ਹੀ ਬਰੀਕ ਆਵਾਜ਼ ਦੇ ਵਿੱਚ ਬੋਲਦਾ ਹੈ ਮੈਂ ਉਹਨੂੰ ਆਪਣੇ ਘਰ ਦੇ ਸਾਰੇ ਫੰਕਸ਼ਨਾਂ ਦੇ ਵਿੱਚ ਉਹਨੂੰ ਹੀ ਕਰਦਾ ਹਾਂ ਉਸਦੀ ਆਵਾਜ਼ ਬਹੁਤ ਹੀ ਬਰੀਕ ਹੈ ਉਹ ਜਦੋਂ ਬੋਲਦਾ ਹੈ ਤਾਂ ਹਾਸਾ ਵੀ ਸਭ ਦਾ ਨਿਕਲ ਜਾਂਦਾ ਹੈ ਅਸੀਂ ਉਸਨੂੰ ਆਪਣਾ ਫੈਮਲੀ ਫੋਟੋਗ੍ਰਾਫਰ ਮੰਨਦੇ ਹਾਂ ਉਹ ਜਦੋਂ ਵੀ ਸਾਡੇ ਫੰਕਸ਼ਨਾਂ ਦੇ ਵਿੱਚ ਆਉਂਦਾ ਹੈ ਬਹੁਤ ਹੀ ਵਧੀਆ ਫੋਟੋਆਂ ਖਿੱਚ ਕੇ ਸਾਨੂੰ ਦਿੰਦਾ ਹੈ ਉਹ ਬਹੁਤ ਹੀ ਵਧੀਆ ਕੰਮ ਕਰਦਾ ਹੈ ਉਸਦੇ ਕੰਮ ਦੇ ਦੇਖ ਕੇ ਹੀ ਉਹਨੂੰ ਹੋਰ ਵੀ ਬਹੁਤ ਸਾਰੇ ਆਡਰ ਮੈਂ ਦਵਾਏ ਹਨ ਉਹ ਜਿੱਥੇ ਵੀ ਆਪਣਾ ਕੰਮ ਕਰਨ ਜਾਂਦਾ ਹੈ ਉੱਥੇ ਉਹਨੂੰ ਵਾਹ ਵਾਹ ਹੀ ਮਿਲਦੀ ਹੈ ਉਹ ਜਦੋਂ ਸਾਡੇ ਫੈਮਿਲੀ ਫੰਕਸ਼ਨਾਂ ਦੇ ਵਿੱਚ ਆਉਂਦਾ ਹੈ ਅਤੇ ਸਭ ਉਸਦਾ ਕੰਮ ਨੂੰ ਦੀ ਸਰਾਹਨਾ ਕਰਦੇ ਹਨ ਅਤੇ ਨਾਲ ਹੀ ਉਸ ਦਾ ਨੰਬਰ ਲੈ ਕੇ ਅੱਗੋਂ ਉਹਨੂੰ ਕੋਂਟੈਕਟ ਕਰਦੇ ਹਨ ਤਾਂ ਕਿ ਉਹ ਵੀ ਆਪਣੇ ਫੰਕਸ਼ਨਾਂ ਜਾਂ ਹੋਰ ਕਿਤੇ ਉਹਨੂੰ ਬੁਲਾ ਸਕਣ